ਮੈਂ ਫਤਿਹਗੜ੍ਹ ਸਾਹਿਬ ਤੋਂ ਬਿਲੋਂਗ ਕਰਦਾ ਜੀ ਇਹ ਅਤੇ ਬਹੁਤ ਸਾਰੇ ਟਰੈਵਲਰ ਟਰੈਵਲਰ ਵਾਲੇ ਹਨ ਅਤੇ ਮੈਨੂੰ ਮੇਰੇ ਮੇਰੇ ਕੋਲ ਜਿਹੜੇ ਗੁਰੂ ਕਿਰਪਾ ਟਰੈਵਲਰ ਹੈ ਇਹਨਾਂ ਦਾ ਬਹੁਤ ਵਧੀਆ ਸੁਭਾਅ ਏ ਜੀ ਇਹ ਅੱਗੇ ਪਿੱਛੇ ਜਿਵੇਂ ਕਿਸੇ ਨੂੰ ਬਾਹਰ ਭੇਜਣਾ ਜਾ ਕਿਤੇ ਘੁੰਮਣ ਜਾਣਾ ਜਾਂ ਗੁਰਦੁਆਰਾ ਸਾਹਿਬ ਜਾਣਾ ਅਤੇ ਮੈਂ ਅੰਮ੍ਰਿਤਸਰ ਜਾਣਾ ਸੀ ਉਹਨਾਂ ਵਾਸਤੇ ਮੈਂ ਬੁੱਕ ਕਰਵਾਇਆ ਸੀ ਅਤੇ ਰੇਟ ਵੀ ਇਹਨਾਂ ਦਾ ਜਾਇਜ਼ਾ ਜਮਾਂ ਹੀ ਜੀ